ਮੈਨੂੰ ਪੁਰਾਣੀ ਯਾਦ ਆਉਂਦੀ ਹੈ ਜਦੋਂ ਸਕੂਲ ਵਿੱਚ ਦੌੜਾਂ ਕਰਵਾਈਆਂ ਗਈਆਂ ਸਨ ਸਾਨੂੰ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਸ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਪਹਿਲਾਂ ਮੈਨੂੰ ਲੱਗਿਆ ਕਿ ਮੈਂ ਇਹ ਨਹੀਂ ਕਰ ਸਕਦਾ ਪਰ ਫਿਰ ਮੇਰੇ ਦੋਸਤਾਂ ਵੱਲੋਂ ਮੈਨੂੰ ਹੱਲਾਸ਼ੇਰੀ ਮਿਲੀ ਕਿ ਤੂੰ ਜ਼ਰੂਰ ਇਹ ਦੌੜ ਵਿੱਚ ਹਿੱਸਾ ਲੈ ਫਿਰ ਮੈਂ ਸੋਚ ਕੇ ਇਸ ਦੌੜ ਵਿੱਚ ਹਿੱਸਾ ਲੈਣ ਨੂੰ ਤਿਆਰ ਹੋ ਗਿਆ ਜਦ ਗਰਾਉਂਡ ਵਿੱਚ ਮੈਂ ਦੂਜੇ ਪਲੇਅਰਾਂ ਨਾਲ ਦੌੜਿਆ ਜਿਸ ਵਿੱਚ ਸੌ ਮੀਟਰ ਦੀ ਦੌੜ ਵੀ ਦੌੜਿਆ ਚਾਰ ਸੌ ਮੀਟਰ ਦੀ ਦੌੜ ਵੀ ਦੌੜਿਆ ਅਤੇ ਹਰਡਲਸ ਵਿੱਚ ਵੀ ਭਾਗ ਲਿਆ ਇਸ ਵਿੱਚ ਮੈਂ ਪੂਰੀ ਉਤਸ਼ਾਹ ਨਾਲ ਦੌੜਿਆ ਅਤੇ ਮੇਰੇ ਦੋਸਤਾਂ ਵੱਲੋਂ ਮੈਨੂੰ ਬਹੁਤ ਜ਼ਿਆਦਾ ਤਾੜੀਆਂ ਮਾਰ ਕੇ ਹੱਲਾਸ਼ੇਰੀ ਵੀ ਦਿੱਤੀ ਗਈ ਨਾਲੇ ਉਹਨਾਂ ਨੇ ਮੇਰੇ ਲਈ ਜਿ ਜਿੱਤਣ ਦੀਆਂ ਵੀ ਦੁਆਵਾਂ ਕੀਤੀਆਂ ਅੱਜ ਵੀ ਮੈਨੂੰ ਇਸ ਦੌੜ ਨੂੰ ਯਾਦ ਕਰਕੇ ਬਹੁਤ ਖੁਸ਼ੀ ਮਿਲਦੀ ਹੈ ਤਾਂ ਇਸ ਖੁਸ਼ੀ ਦਾ ਮੈਂ ਆਪ ਜੀ ਦਾ ਸਾਂਝੀ ਕਰ ਰਿਹਾ ਹਾਂ